ਮੇਰੇ ਘਰ ਦੇ ਰਸੋਈ ਦੇ ਵਿੱਚ ਬਹੁਤ ਸਾਰੇ ਭਾਂਡੇ ਹਨ ਪਰ ਉਨ੍ਹਾਂ ਵਿੱਚੋਂ ਮੈਨੂੰ ਕੁੱਕਰ ਸਭ ਤੋਂ ਵੱਧ ਪਸੰਦੀਦਾਰ ਭਾਂਡਾ ਲੱਗਿਆ ਕਿਉਂਕਿ ਉਹ ਬਹੁਤ ਹੀ ਉਸ ਵਿੱਚ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਬਣਾ ਸਕਦੇ ਹਨ